ਮੈਂ ਬਾਗਬਾਨੀ ਆ ਆਪਣੇ ਇੱਕ ਦੋਸਤ ਵੱਲ ਵੇਖ ਕੇ ਸ਼ੁਰੂ ਕੀਤੀ ਸੀ ਮੇਰੇ ਦੋਸਤ ਨੇ ਪਿਛਲੇ ਕੁਝ ਸਮੇਂ ਤੋਂ ਆਪਣੇ ਦੋ ਕਿੱਲੇ ਦੇ ਵਿੱਚ ਅਮਰੂਦਾਂ ਦਾ ਬਾਗ ਲਾਇਆ ਸੀ ਅਤੇ ਉਹਦਾ ਦੇਖ ਰਿਹਾ ਸੀ ਮੈਂ ਤਿੰਨ ਸਾਲ ਬਾਅਦ ਉਹਨੂੰ ਚੰਗੀ ਆਮਦਨ ਹੋਣੀ ਸ਼ੁਰੂ ਹੋ ਗਈ ਅਤੇ ਉਹਦਾ ਜਿਹੜਾ ਪਰਿਵਾਰ ਸੀ ਉਹ ਚੰਗੇ ਖੁਸ਼ਹਾਲੀ ਵੱਲ ਵੱਧ ਗਿਆ ਉਹਦੇ ਵੱਲ ਵੇਖ ਕੇ ਹੀ ਫਿਰ ਮੈਂ ਵੀ ਪਿਛਲੇ ਦੋ ਕੁ ਸਾਲ ਤੋਂ ਬਾਗਬਾਨੀ ਸ਼ੁਰੂ ਕੀਤੀ ਆ ਮੈਂ ਤਾਂ ਅਲੱਗ ਅਲੱਗ ਕਿਸਮ ਦੇ ਕਈ ਤਰ੍ਹਾਂ ਦੇ ਫਲ ਲਾਏ ਆ ਜਿਵੇਂ ਅਮਰੂਦ ਹੋ ਗਿਆ ਕਿੰਨੂ ਨਾਸ਼ਪਾਤੀ ਨਿੰਬੂ ਆਦਿ ਦੇ ਬੂਟੇ ਵੀ ਲਾਏ ਆ ਇਹਨਾਂ ਦੇ ਵਿੱਚ ਕੋਈ ਜ਼ਿਆਦਾ ਕੰਮ ਵੀ ਨਹੀਂ ਕਰਨਾ ਪੈਂਦਾ ਮਿਹਨਤ ਵੀ ਥੋੜ੍ਹੀ ਪੈਂਦੀ ਆ ਅਤੇ ਇਹਨਾਂ ਦੀ ਸਾਂਭ ਸੰਭਾਲ ਵੀ ਬਹੁਤ ਘੱਟ ਆ ਸਾਡੇ ਜਿਹੜਾ ਪੰਜਾਬ ਦਾ ਮੌਸਮ ਆ ਉਹ ਵੀ ਇਹਨਾਂ ਦੇ ਬਹੁਤ ਅਨੁਕੂਲ ਆ ਇਹਦੇ ਇਹਦੀ ਵਜ੍ਹਾ ਨਾਲ ਹੀ ਸਾਡਾ ਜਿਹੜਾ ਮੰਡੀਕਰਨ ਵੀ ਨੇੜੇ ਹੋਣ ਕਰਕੇ ਸਾਨੂੰ ਕੋਈ ਮੰਡੀ ਦੀ ਮੁਸ਼ਕਲ ਨਹੀਂ ਆਉਂਦੀ ਅਤੇ ਸਾਡਾ ਜਿਹੜਾ ਵਾ ਉਹ ਜਦੋਂ ਫਲ ਦੀ ਤੁੜਾਈ ਹੁੰਦੀ ਆ ਤਾਂ ਨਾਲ ਦੀ ਨਾਲ ਸਾਨੂੰ ਮੰਡੀ ਪਹੁੰਚਾਉਣਾ ਵੀ ਸੌਖਾ ਵਾ ਅਤੇ ਮੰਡੀ 'ਚੋਂ ਲੋਕ ਖਰੀਦ ਲੈਂਦੇ ਆ ਜਿਹੜੇ ਉਹ ਅਲੱਗ ਅਲੱਗ ਸ਼ਹਿਰ ਦੇ ਵਿੱਚ ਅਲੱਗ ਅਲੱਗ ਥਾਵਾਂ 'ਤੇ ਰੇਹੜੀਆਂ ਦੇ ਉੱਪਰ ਦੁਕਾਨਾਂ ਦੇ ਉੱਪਰ ਵੇਚ ਲੈਂਦੇ ਆ ਅਤੇ ਕਾਫੀ ਕਮਾਈ ਹੋ ਜਾਂਦੀ ਆ ਸਾਡਾ ਜਿਹੜਾ ਪਰਿਵਾਰ ਆ ਉਹ ਖੁਸ਼ਹਾਲੀ ਵੱਲ ਵੱਧ ਰਿਹਾ ਵਾ ਜਦੋਂ ਦੀ ਬਾਗਬਾਨੀ ਸ਼ੁਰੂ ਕੀਤੀ ਆ ਬਹੁਤ ਲਾਹੇਵੰਦ ਆ ਧੰਦਾ ਵਾ ਅਤੇ ਮੈਂ ਤਾਂ ਇਹ ਸਲਾਹ ਦੇਣਾ ਚਾਹੁੰਦਾ ਵੀ ਲੋਕ ਜਿਹੜੇ ਵੱਧ ਤੋਂ ਵੱਧ ਬਾਗਬਾਨੀ ਨੂੰ ਅਪਣਾਉਣ